ਹਾਂਜੀ ਮੈਂ ਵੀ ਸੂਟਾਂ ਦੀ ਸਿਲਾਈ ਗੀ ਕਰਦੀ ਹਾਂ ਮੈਂ ਘਰ ਤੋਂ ਹੀ ਆਪਣੇ ਬੁਟੀਕ ਰਨ ਕਰਦੀ ਹਾਂ ਤਾਂ ਬਸ ਜਿਹੜਾ ਤੁਸੀਂ ਜਿਵੇਂ ਕੀਮਤ ਬਾਰੇ ਪੁੱਛਿਆ ਉਹ ਦੇਖੋ ਦੇਖ ਲਈਦਾ ਪਰਸਨ ਟੂ ਪਰਸਨ ਕਿਉਂਕਿ ਸਾਡਾ ਜੋ ਵੀ ਜਿੱਥੇ ਮੇਰੀ ਸ਼ੌਪ ਹੈ ਉੱਥੇ ਏਰੀਆ ਥੋੜ੍ਹਾ ਜਿਹਾ ਬੈਕਵਰਡ ਆ ਜਾਂਦਾ ਤਾਂ ਚਲੋ ਉਸ ਹਿਸਾਬ ਨਾਲ ਲੈ ਲਈਦੇ ਜਿਵੇਂ ਜੇ ਕੋਈ ਅੱਛਾ ਪਰਸਨ ਆ ਗਿਆ ਤਾਂ ਉਸ ਹਿਸਾਬ ਨਾਲ ਲੈ ਲਏ ਜੇ ਕੋਈ ਠੀਕ ਹੈ ਚਲੋ ਤਾਂ ਉਹਨਾਂ ਨੂੰ ਦੇਖ ਲਈਦਾ ਵੀ ਚਲੋ ਗਰੀਬ ਆਦਮੀ ਹੈ ਨਹੀਂ ਇੰਨਾਂ ਦੇ ਸਕਦੇ ਬਾਕੀ ਇਹ ਹੁੰਦਾ ਵੀ ਵੱਖ ਵੱਖ ਸੂਟਾਂ ਦੇ ਵੱਖ ਵੱਖ ਰੇਟ ਹੁੰਦੇ ਹੈ ਜਿਸ ਤਰ੍ਹਾਂ ਕੋਈ ਜੇ ਕੋਈ ਡਿਜ਼ਾਇਨਰ ਜੇ ਕੋਈ ਪਾਈਪਿੰਗ ਵਗੈਰਾ ਐਡ ਕਰਵਾ ਰਿਹਾ ਜਾਂ ਕੋਈ ਲੇਸਸ ਵਗੈਰਾ ਐਡ ਕਰਵਾ ਰਿਹਾ ਤਾਂ ਉਹਨਾਂ ਦੇ ਅਲੱਗ ਰੇਟ ਹੁੰਦੇ ਹੈ ਕੋਈ ਅੱਜ ਕੱਲ੍ਹ ਦੇਖੋ ਸਭ ਤੋਂ ਜ਼ਿਆਦਾ ਤਾਂ ਲੇਡੀਜ ਸੂਟਾਂ ਦੇ ਡਿਜ਼ਾਈਨ ਹੀ ਚੱਲ ਰਹੇ ਹੈ ਹਰ ਇੱਕ ਨੂੰ ਹਰ ਭਲਾ ਸੂਟ ਉਹਨਾਂ ਦਾ ਸਸਤਾ ਹੋਵੇ ਤਾਂ ਪਰ ਉਹਨਾਂ ਨੂੰ ਰੇਟ ਮਤਲਬ ਡਿਜ਼ਾਇਨ ਵਧੀਆ ਚਾਹੀਦਾ ਹੈ ਵੀ ਮੇਰਾ ਸੂਟ ਸੀਤਾ ਸੋਹਣਾ ਹੋਵੇ ਤਾਂ ਉਸ ਹਿਸਾਬ ਨਾਲ ਤਿਆਰ ਕਰੀਦਾ ਹੈ ਫਿਰ ਉਸ ਹਿਸਾਬ ਨਾਲ ਰੇਟ ਲਗਾ ਲਈਦਾ ਹੈ ਬਾਕੀ ਇਹ ਹੀ ਜੇ ਹੁਣ ਮੇਰਾ ਜਿਵੇਂ ਏਰੀਆ ਸਾਡਾ ਥੋੜ੍ਹਾ ਘੱਟ ਹੈ ਜੇ ਇਹ ਹੀ ਮੈਂ ਸ਼ਹਿਰ 'ਚ ਬੈਠੀ ਹੋਵਾਂ ਜਾਂ ਕਿਸੇ ਵੱਡੇ ਸ਼ਹਿਰ 'ਚ ਬੈਠੀ ਹੋਵਾਂ ਤਾਂ ਮੈਂ ਉਸ ਹਿਸਾਬ ਨਾਲ ਰੇਟ ਲੈ ਸਕਦੀ ਹਾਂ ਜਿਸ ਨਾਲ ਮੈਨੂੰ ਹੋਰ ਜ਼ਿਆਦਾ ਬੈਨੀਫਿਟ ਹੋ ਜਾਂਦਾ ਹੈ ਤਾਂ ਬਾਕੀ ਜਿਵੇਂ ਫੰਕਸ਼ਨ ਟਾਈਮ ਹੁੰਦੇ ਹੈ ਉਦੋਂ ਫੰਕਸ਼ਨਾਂ ਵਾਲੇ ਜਿਹੜੇ ਸੂਟ ਤਿਆਰ ਕਰੀਦੇ ਹੈਵੀ ਇਮਬਰ ਇਮਬਰੋਇਡਰੀ ਵਗੈਰਾ ਵਾਲੇ ਤਾਂ ਉਹਨਾਂ ਦਾ ਰੇਟ ਅਲੱਗ ਲੈ ਲਈ ਦਾ ਹੈ ਉਹਨਾਂ ਨੂੰ ਕਰਨ 'ਚ ਕਾਫੀ ਦਿੱਕਤ ਆਉਂਦੀ ਹੈ ਅਤੇ ਬਾਕੀ ਬਸ ਸਾਰਾ ਅਲੱਗ ਅਲੱਗ ਹੀ ਦੇਖ ਲਈ ਦਾ ਆਪਣਾ ਵਿੰਟਰ ਦਾ ਜਾਂ ਗਰਮੀ ਦਾ ਜਿਹੜੇ ਸਟਿਚ ਕਰਨੇ ਹੈ ਜਾਂ ਕੋਈ ਮਿਡੀ ਫਰੋਕ ਵਗੈਰਾ ਉਹ ਚੀਜ਼ ਬਣਾਉਣੀ ਹੈ ਇਹ ਹਿਸਾਬ ਹੋ ਜਾਂਦਾ ਸਾਰਾ ਅਤੇ ਬਾਕੀ ਇਹ ਵੀ ਹੈ ਵੀ ਕਈ ਵਾਰ ਦੇਖ ਲਈ ਦਾ ਜ਼ਿਆਦਾ ਵੀ ਰੇਟ ਕਾਫ਼ੀ ਲੈਂਦੇ ਲਾਈਨਿੰਗ ਵਾਲੇ ਸੂਟ ਹੈ ਜਿਹੜੇ ਉਹਨਾਂ ਦਾ ਕਾ ਡਬਲ ਲੈ ਲਈ ਦਾ ਕਿਉਂਕਿ ਵੈਸੇ ਵੀ ਉਹਨਾਂ 'ਚ ਮਿਹਨਤ ਜ਼ਿਆਦਾ ਪੈਂਦੀ ਹੈ ਲਾਈਨਿੰਗ ਵਾਲਿਆਂ ਦੇ ਤਾਂ ਓਬੇਸਲੀ ਰੇਟ ਜ਼ਿਆਦਾ ਹੀ ਹੁੰਦੇ ਹੈ ਪਰ ਫਿਰ ਵੀ ਐਂ ਆ ਵੀ ਬਾਕੀ ਸ਼ਹਿਰ ਨਾਲੋਂ ਬਾਕੀ ਬੁਟੀਕਸ ਰੇਟ ਨਾਲੋਂ ਕਾਫ਼ੀ ਲੋ ਲੈ ਲਈ ਦੇ ਹੈ ਵੀ ਚਲੋ ਜਿਹੜਾ ਇਹ ਏਰੀਆ ਉਸ ਹਿਸਾਬ ਨਾਲ ਤਾਂ ਇਸ ਤਰ੍ਹਾਂ ਸੈਟਿੰਗ ਆ ਜਾਂਦੀ ਹੈ ਆਪਣਾ ਘਰ ਬਾਰ ਦਾ ਚਲੋ ਚਲ ਜਾਂਦਾ ਵੀ ਕਿਸੇ ਅੱਗੇ ਹੱਥ ਨਹੀਂ ਅੱਡਣੇ ਪੈਂਦੇ ਆਪਣਾ ਖਰਚਾ ਆਪ ਕੱਡੀ ਦਾ ਹੈ ਸੋ ਠੀਕ ਹੈ